ਪੰਜਾਬੀ ਭਾਸ਼ਾ ਬਹੁਤ ਹੀ ਸਰਲ ਅਤੇ ਮਿੱਠੀ ਭਾਸ਼ਾ ਹੈ ਇਸ ਨੂੰ ਹਰ ਬੰਦਾ ਆਸਾਨੀ ਨਾਲ ਸਮਝ ਕੇ ਬੋਲ ਅਤੇ ਸਿੱਖ ਸਕਦਾ ਹੈ ਪੰਜਾਬੀ ਭਾਸ਼ਾ ਨਾ ਕਿ ਆਪਣੇ ਖੇਤਰ ਵਿੱਚ ਬਲਕਿ ਦੇਸ਼ ਵਿਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ ਇਸ ਨੇ ਅਲੱਗ ਅਲੱਗ ਭਾਸ਼ਾਵਾਂ ਦੇ ਵਿਕਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਸੱਭਿਆਚਾਰਕ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ 'ਤੇ ਕਰਵਾਏ ਜਾਂਦੇ ਹਨ ਇੱਥੇ ਹਰ ਵਰਗ ਦੇ ਲੋਕ ਜਿਹਨਾਂ ਦੀਆਂ ਭਾਸ਼ਾਵਾਂ ਅਲੱਗ ਅਲੱਗ ਹਨ ਇੱਥੇ ਆਉਂਦੇ ਹਨ ਅਤੇ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਹਨ